ਪੰਜਾਬੀਆਂ ਲਈ ਮਹਿਮਾਨ ਤਾਂ ਜੀਅ ਸਦਕੇ ਹੁੰਦੇ ਨੇ ਇਸ ਤਰ੍ਹਾਂ ਜਦ ਸਾਡੇ ਘਰ ਮਹਿਮਾਨ ਆਉਂਦੇ ਆ ਤਾਂ ਐਂ ਲੱਗਦਾ ਕੋਈ ਰੌਣਕ ਹੀ ਆ ਗਈ ਹੈ ਕਿਉਂਕਿ ਜਿਵੇਂ ਮਹਿਮਾਨ ਆਉਂਦੇ ਨੇ ਉਹ ਉਹਨਾਂ ਦੇ ਨਾਲ ਸਾਡਾ ਵੀ ਜਿਹੜਾ ਵਾਤਾਵਰਨ ਹੈ ਘਰ ਦਾ ਮਾਹੌਲ ਆ ਉਹ ਬਦਲ ਜਾਂਦਾ ਹੈ ਖੁਸ਼ ਨੁਮਾਰ ਹੋ ਜਾਂਦਾ ਹੈ ਜਦ ਤੁਹਾਡੀ ਹੀ ਛੱਤ ਹੇਠਾਂ ਕੋਈ ਆਉਂਦਾ ਆ ਤਾਂ ਉਹ ਤੁਹਾਨੂੰ ਕੁਛ ਸਿਖਾ ਕੇ ਹੀ ਜਾਂਦਾ ਹੈ ਜਦ ਚਾਰ ਗੱਲਾਂ ਹੁੰਦੀਆਂ ਤਾਂ ਸਾਨੂੰ ਵੀ ਤਾਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਜੇ ਉਹ ਸਾਨੂੰ ਦੱਸਦੇ ਹੈ ਤਾਂ ਅਸੀਂ ਵੀ ਕੁਝ ਉਹਨਾਂ ਨੂੰ ਦੱਸਦੇ ਹੈ ਗੱਲਾਂ ਬਾਤਾਂ ਹੁੰਦੀਆਂ ਜ਼ਿੰਦਗੀ ਅੱਗੇ ਚੱਲਦੀ ਜਾਂਦੀ ਆ ਠੀਕ ਇਸ ਤਰ੍ਹਾਂ ਜਦ ਘਰ ਕੋਈ ਆਉਂਦਾ ਆ ਫਿਰ ਇੱਕ ਨਵੀਂ ਹੋੜ ਲੱਗੀ ਹੋਈ ਹੁੰਦੀ ਆ ਵੀ ਜਿਹੜਾ ਮਹਿਮਾਨ ਆਉਣ ਲੱਗਾ ਆ ਉਹਨੂੰ ਕੀ ਖਾਣ 'ਚ ਪਸੰਦ ਆ ਜਿਹੜਾ ਅਸੀਂ ਬਣਾਵਾਂਗੇ ਉਹਨੂੰ ਉਹ ਪਸੰਦ ਆਉਗਾ ਵੀ ਕਿ ਨਹੀਂ ਮੈਂ ਤਾਂ ਇਸ ਲਈ ਜਦ ਮੇਰੇ ਘਰ ਕੋਈ ਆਉਣ ਲੱਗਦਾ ਆ ਉਹ ਜਦ ਮੈਨੂੰ ਦੱਸ ਦਿੰਦੇ ਵੀ ਅਸੀਂ ਤੁਹਾਡੇ ਘਰ ਆਉਣਾ ਆ ਉਹਨੂੰ ਫ਼ੋਨ 'ਤੇ ਹੀ ਪੁੱਛ ਲੈਂਦੀ ਹਾਂ ਭਈ ਤੁਸੀਂ ਕੀ ਖਾਣਾ ਪਸੰਦ ਕਰੂੰਗੇ ਬੜਾ ਬਾਹਲਾ ਚੰਗਾ ਲੱਗਦਾ ਆ ਜਦ ਤੁਸੀਂ ਅਗਲੇ ਦੀ ਪਸੰਦ ਬਣਾਉਂਦੇ ਹੋ ਆਪਣੀ ਪਸੰਦ ਤਾਂ ਤੁਸੀਂ ਰੋਜ਼ ਹੀ ਬਣਾ ਕੇ ਖਾ ਲੈਂਦੇ ਹੋ ਮਗਰ ਜਦ ਕੋਈ ਆਇਆ ਤੁਹਾਡੇ ਘਰ ਔਰ ਤੁਸੀਂ ਉਹਨੂੰ ਉਹਦੀ ਪਸੰਦ ਔਰ ਉਹਦਾ ਟੇਸਟ ਦਾ ਖਵਾਓ ਇਹ ਹੀ ਸਭ ਤੋਂ ਵਧੀਆ ਹੈ ਧੰਨਵਾਦ